ਮੈਨੂੰ ਨਹੀਂ ਲੱਗਦਾ ਕਿ ਸਾਡੇ ਖੇਤਰ ਵਿੱਚ ਸ੍ਰੋਤਾਂ ਦੀ ਕੋਈ ਘਾਟ ਹੈ ਕਿਉਂਕਿ ਸਰਕਾਰ ਵੱਲੋਂ ਬਹੁਤ ਸਾਰੀਆਂ ਸਹੂਲਤਾਂ ਸਾਨੂੰ ਪ੍ਰਦਾਨ ਕੀਤੀਆ ਗਈਆ ਹਨ ਜਿਸ ਵਿੱਚ ਟੀਕਾਕਰਨ ਵੀ ਹੈ ਅਤੇ ਟੀਕਾਕਰਨ ਹਰੇਕ ਛੋਟੇ ਤੋਂ ਛੋਟੇ ਤੋਂ ਲੈ ਕੇ ਬੜੇ ਤੋਂ ਬੜੇ ਤੱਕ ਲਈ ਹਰੇਕ ਸਹੂਲਤਾਂ ਪ੍ਰਦਾਨ ਕੀਤੀਆਂ ਗਈਆ ਹਨ ਹਰੇ ਅਤੇ ਹਰੇਕ ਸਹੂਲਤ ਸਮੇਂ ਸਿਰ ਪਹੁੰਚ ਜਾਂਦੀ ਹੈ ਧੰਨਵਾਦ